ਹੈਲੋ ਜੀ ਮੈਂ ਲੈਕਚਰਰ ਬੋਲ ਰਈ ਆਂ ਅ ਜੀ ਮੈਨੂੰ ਤਾਂ ਕੰਪਲੇਂਟ ਕਰਨੀ ਸੀ ਤੁਹਾਡੀ ਯੂਨੀਵਰਸਿਟੀ ਦੀ ਕਲਾਸ ਦੇ ਰਿਗਾਡਿੰਗ ਮੈਮ ਦਿੱਕਤ ਇੱਕ ਹੋਵੇ ਤਾਂ ਗੱਲ ਕਰੀਏ ਨਾ ਐਥੇ ਤਾਂ ਬਹੁਤ ਜਿਆਦਾ ਪ੍ਰੋਬਲਮ ਆ ਰੀ ਐ ਮੈਮ ਪਹਿਲੀ ਗੱਲ ਤਾਂ ਬੇਸਿਕ ਰਿਕੁਆਇਰਮੈਂਟ ਜੋ ਕਲਾ ਸਟੂਡੈਂਟ ਦੀ ਐ ਉਹ ਸਾਡੇ ਸਮਾਟ ਬੋਰਡ ਈ ਨੀ ਚੱਲ ਰਿਆ ਪ੍ਰੋਪਰਲੀ ਮੈਨੂੰ ਤਾਂ ਵਿੱਚ ਈ ਕੋਈ ਦਿੱਕਤ ਲੱਗ ਰਹੀ ਕਿਉਂਕੀ ਵਾਈ ਫਾਈ ਭਾਵੇਂ ਚੱਲ ਵੀ ਰਿਆ ਹੁੰਦਾ ਐ ਫੇਰ ਵੀ ਉਹ ਚੰਗੀ ਤਰ੍ਹਾਂ ਕੰਮ ਨੀ ਕਰਦਾ ਹਾਂਜੀ ਹਾਂਜੀ ਤੇ ਮੈਮ ਹੀਟਰਸ ਵੀ ਸਹੀ ਕਰਾ ਦੋ ਪਿਛਲੀ ਸਰਦੀਆਂ ਦੇ ਖਰਾਬ ਹੋਏ ਹੋਏ ਐ ਸਾਲ ਹੋਣ ਨੂੰ ਆ ਗਿਆ ਹੁਣ ਤੱਕ ਨੀ ਸਹੀ ਹੋਏ ਸਰਦੀਆਂ ਕਿਵੇਂ ਨਿਕਲਣ ਗੀਆਂ ਪ੍ਰੋਪਰ ਹੀਟ ਪ੍ਰੋਵਾਈਡ ਨੀ ਹੋ ਰੀ ਐ ਹਾਂਜੀ ਤੇ ਕੰਪਿਊਟਰ ਵਿੱਚ ਵੀ ਦਿੱਕਤ ਐ ਕੰਪਿਊਟਰ ਲੈਬ ਦੇ ਵਿੱਚ ਇੱਕ ਦਾ ਕੀਬੋਰਡ ਨੀ ਚੱਲ ਰਿਆ ਤੇ ਇੱਕ ਦਾ ਸੀ ਪੀ ਯੂ ਵੀ ਨੀ ਓਨ ਹੁੰਦਾ ਠੀਕ ਐ ਮੈਮ ਤੁਸੀਂ ਪਲੀਸ ਆਹ ਸਾਰਾ ਕੁਛ ਜਲਦੀ ਤੋਂ ਜਲਦੀ ਵੇਖੋ ਐਮੇ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਐ ਠੀਕ ਐ ਜੀ ਓਕੇ ਸ਼ੁਕਰੀਆ ਸ਼ੁਕਰੀਆ ਮੈਮ